ਹਾਂਜੀ ਆਪਣੇ ਜਿਹੜੇ ਪ੍ਰਾਹੁਣਾਚਾਰੀ ਦਾ ਪੰਜਾਬੀ ਕਲਚਰ ਦੇ ਵਿੱਚ ਬਹੁਤ ਹੀ ਖਾਸ ਜਗ੍ਹਾ ਜਿਹੜੀ ਪ੍ਰਾਹੁਣਾਚਾਰੀ ਦੀ ਆਪਣੇ ਅਤੇ ਅੱਜ ਕੱਲ੍ਹ ਜਿਵੇਂ ਆਪਣੇ ਘਰਾਂ ਵਿੱਚ ਮਹਿਮਾਨ ਆਉਂਦੇ ਪ੍ਰਾਹੁਣੇ ਆਉਂਦੇ ਆਪਣੇ ਹੈ ਨਾ ਉਹਨਾਂ ਦਾ ਵੀ ਬਹੁਤ ਇੱਜ਼ਤ ਮਾਣ ਸਤਿਕਾਰ ਕਰਦੇ ਹਾਂ ਆਪਾਂ ਉਹਨਾਂ ਦਾ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੀ ਪ੍ਰਾਹੁਣਾਚਾਰੀ ਦਾ ਅਤੇ ਜਿਵੇਂ ਮੰਨ ਕੇ ਚਲੋ ਆਪਣੇ ਕੋਲ ਗੁਆਂਢੀਆਂ ਦੇ ਆਪਣੇ ਪਿੰਡ ਦੇ ਵਿੱਚ ਹੀ ਕੋਈ ਪ੍ਰਾਹੁਣਾ ਕਿਸੇ ਦੇ ਆ ਜਾਂਦੇ ਸੀ ਅਤੇ ਆਪਾਂ ਆਂਢੀ ਗੁਆਂਢੀ ਵੀ ਪੂਰਾ ਉਹਦੇ ਸਾਰਾ ਪਿੰਡ ਹੀ ਲਗਭਗ ਸਤਿਕਾਰ ਕਰਦਾ ਸੀ ਉਹਦਾ ਪੂਰਾ ਇੱਜ਼ਤ ਮਾਣ ਕੀਤਾ ਜਾਂਦਾ ਸੀ ਪ੍ਰਾਹੁਣਾ ਪ੍ਰਾਹੁਣੇ ਦਾ ਅਤੇ ਅੱਜ ਕੱਲ੍ਹ ਜਿਵੇਂ ਲਾ ਲਓ ਵੀ ਥੋੜ੍ਹਾ ਜਿਹਾ ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਅੱਗੇ ਨਾਲੋਂ ਘੱਟ ਗਿਆ ਅੱਗੇ ਨਾਲੋਂ ਪਰ ਅੱਜ ਕੱਲ੍ਹ ਵੀ ਫਿਰ ਵੀ ਜਿਹੜੇ ਪੰਜਾਬੀ ਲੋਕ ਆ ਉਸ ਚੀਜ਼ ਦਾ ਬਹੁਤ ਸਤਿਕਾਰ ਕਰਦੇ ਜਿਹੜੇ ਪ੍ਰਾਹੁਣਾਚਾਰੀ ਦਾ ਉਹਨਾਂ ਦੇ ਰਹਿਣ ਸਹਿਣ ਦਾ ਖਾਸ ਪ੍ਰਬੰਧ ਰ ਕੀਤਾ ਜਾਂਦਾ ਖਾਣ ਪੀਣ ਦਾ ਵਧੀਆ ਇੱਜ਼ਤ ਮਾਣ ਸਤਿਕਾਰ ਪੂਰਾ ਦਿੱਤਾ ਜਾਂਦਾ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਗੱਲ ਦੀ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਂਦੀ ਅਤੇ ਬਹੁਤ ਹੀ ਬਾਕੀ ਅੱਜ ਕੱਲ੍ਹ ਵਧੀਆ ਚੱਲ ਰਿਹਾ ਜਿਵੇਂ ਕੋਈ ਵੀ ਆਪਾਂ ਆਪਣੇ ਘਰ ਪ੍ਰਾਹੁਣਾ ਆ ਜਾਂਦਾ ਠੀਕ ਆ ਆਪਾਂ ਉਹਨੂੰ ਵਧੀਆ ਸਤਿਕਾਰ ਨਾਲ ਹੈ ਨਾ ਰੱਖਦੇ ਹਾਂ ਅਤੇ ਕਈ ਕਈ ਦਿਨ ਆਪਾਂ ਜਿਵੇਂ ਅੱਜ ਤੋਂ ਪਹਿਲਾਂ ਤਾਂ ਕਾਫੀ ਕਾਫੀ ਦਿਨ ਜਿਵੇਂ ਪਰੋ ਪ੍ਰਾਹੁਣੇ ਆਪਣੇ ਘਰ ਰਹਿ ਕੇ ਜਾਂਦੇ ਸੀਗੇ ਅਤੇ ਅੱਜ ਤਾਂ ਅੱਜ ਕੱਲ੍ਹ ਥੋੜ੍ਹਾ ਜਿਹਾ ਵੀ ਕੰਮ ਚਾਲ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਨਾਲੋਂ ਫਰਕ ਆ ਵੀ ਹੁਣ ਥੋੜ੍ਹਾ ਜਿਹਾ ਟਾਈਮ ਦੇ ਹਿਸਾਬ ਨਾਲ ਵੀ ਘੱਟ ਲੋਕਾਂ ਕੋਲ ਸਮਾਂ ਅਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਤਾਂ ਕਾਫੀ ਕਾਫੀ ਦਿਨ ਲੋਕਾਂ ਦਾ ਜਿਵੇਂ ਆਉਂਦੇ ਸੀ ਪ੍ਰਾਹੁਣਾ ਚੰਗਾ ਸਤਿਕਾਰ ਕੀਤਾ ਜਾਂਦਾ ਸੀ ਉਹ ਖਾਸ ਧਿਆਨ ਰੱਖਿਆ ਜਾਂਦਾ ਸੀ ਉਹਨਾਂ ਦਾ ਅਤੇ ਵਧੀਆ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ਾਂ ਦਾ ਬਹੁਤ ਕ ਖਾਸ ਧਿਆਨ ਰੱਖਿਆ ਜਾਂਦਾ ਪ੍ਰਾਹੁਣਾਚਾਰੀ ਦਾ